ਸਰਕਾਰ ਸਾਡੇ ਭਾਈਚਾਰੇ ਵਿੱਚ ਬਿਮਾਰੀਆਂ ਵੀ ਬਾਰੇ ਵਿੱਦਿਅਕ ਅਤੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਚਲਾ ਰਹੀ ਹੈ ਜਿਵੇਂ ਕਿ ਐੱਚ ਆਈ ਵੀ ਹੋ ਗਿਆ ਐੱਸ ਈ ਬੀ ਹੋ ਗਿਆ ਐੱਚ ਬੀ ਐੱਸ ਏ ਜੀ ਹੋ ਗਿਆ ਨਸ਼ਿਆਂ ਦੇ ਕਾਰਨ ਇਹ ਕਾਫੀ ਚੀਜ਼ਾਂ ਵੱਧ ਚੁੱਕੀਆਂ ਹਨ ਨਸ਼ਾ ਇੱਕ ਕੋਡ ਬਣ ਗਿਆ ਪੰਜਾਬ ਦੇ ਵਿੱਚ ਜਿਸ ਕਾਰਨ ਸਰਕਾਰ ਨੇ ਕਈ ਜ਼ਿਆਦਾ ਪ੍ਰੋਗਰਾਮ ਚਲਵਾਏ ਹਨ ਕਿਉਂਕਿ ਨਸ਼ਿਆਂ ਕਾਰਨ ਜਿਹੜਾ ਐੱਚ ਆਈ ਬੀ ਐੱਸ ਈ ਬੀ ਐੱਚ ਬੀ ਐੱਸ ਈ ਜੀ ਬਹੁਤ ਜਲਦੀ ਫੈਲ ਰਿਹਾ ਹੈ ਨ ਇਸ ਤੋਂ ਰੋਕਥਾਮ ਕਿਵੇਂ ਕਰਨੀ ਹੈ ਅਸੀਂ ਕਿਵੇਂ ਬਚਾ ਕਰ ਸਕਦੇ ਹਾਂ ਇਹਦੇ ਅਲੱਗ ਅਲੱਗ ਸੈਂਟਰ ਖੋਲ੍ਹੇ ਗਏ ਹਨ ਇਹਨਾਂ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹੈ ਜਿਹੜੀ ਦਵਾਈ ਬਾਹਰ ਅੱਸੀ ਨੱਬੇ ਹਜ਼ਾਰ ਰੁਪਏ ਦੀ ਹੈਗੀ ਹੈ ਉਹ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ ਅਗਰ ਕੋਈ ਨਸ਼ੇ ਤੋਂ ਪੀੜਿਤ ਹੈਗਾ ਹੈ ਤਾਂ ਉਸਦਾ ਇਲਾਜ ਸਰਕਾਰੀ ਹਸਪਤਾਲ ਚ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਉਹਦਾ ਰਹਿਣਾ ਖਾਣਾ ਸਭ ਕੁਝ ਫ੍ਰੀ ਹੁੰਦਾ ਹੈ ਈਵਨ ਕਿ ਦਵਾਈਆਂ ਦਾ ਖ਼ਰਚਾ ਵੀ ਸਰਕਾਰ ਵੱਲ ਵੱਲੋਂ ਹੀ ਚੱਕਿਆ ਜਾਂਦਾ ਹੈ